ਮੇਰੀ ਮਨਪਸੰਦ ਕਿਤਾਬ ਹੈ ਜਿਹੜੀ ਉਹ ਵਰਿਆਮ ਸਿੰਘ ਸੰਧੂ ਦਾ ਸਫਰਨਾਮਾ ਏ ਵਗਦੀ ਏ ਰਾਵੀ ਓਹਦਾ ਨਾਂ ਆ ਜੋ ਕਿ ਓਹਨੇ ਪਾਕਿਸਤਾਨ ਦੇ ਵਿੱਚ ਵਿਜੀਟ ਕੀਤਾ ਸੀ ਓਹਦੇ ਬਾਰੇ ਲਿਖਿਆ ਹੋਇਆ ਹੈ ਇਹ ਮੈਨੂੰ ਮਤਲਬ ਮੇਰੀ ਪਸੰਦੀਦਾ ਕਿਤਾਬ ਹੈ ਅਤੇ ਇਹਦੇ ਵਿੱਚ ਮੈਂ ਤਾਂ ਵਾਰ ਵਾਰ ਇਹਨੂੰ ਪੜ੍ਹਦੀ ਹਾਂ ਤਾਂ ਮੈਨੂੰ ਇਹ ਬਹੁਤ ਚੰਗੀ ਲਗਦੀ ਹੈ ਕਿਉਂਕਿ ਇਹਦੇ ਵਿੱਚ ਸਾਂਝੇ ਪੰਜਾਬ ਬਾਰੇ ਜਿਹੜਾ ਦੱਸਿਆ ਗਿਆ ਕਿ ਕਿਵੇਂ ਸਾਡੀ ਬੋਲੀ ਸਾਂਝੀ ਹੈ ਕਿਵੇਂ ਅਸੀਂ ਇੱਕੋ ਤਰ੍ਹਾਂ ਦੇ ਲੋਕ ਹਾਂ ਕਿਵੇਂ ਸਾਡਾ ਜਿਹੜਾ ਸੱਭਿਆਚਾਰ ਸਾਂਝਾ ਹੈ ਅਤੇ ਕਿਵੇਂ ਪਾਕਿਸਤਾਨ ਦੇ ਲੋਕ ਨੇ ਜਿਹੜੇ ਓਹ ਸਾਡੇ ਇੱਧਰਲੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਮੁਹੱਬਤ ਕਰਦੇ ਨੇ ਅਤੇ ਜੋ ਕਿ ਬਹੁਤ ਜ਼ਿਆਦੇ ਓਹਦੇ ਵਿੱਚ ਲੇਖਕ ਨੂੰ ਵੀ ਬਹੁਤ ਵਧੀਆ ਲੱਗਦਾ ਉਹ ਇੱਕ ਕਾਨਫਰੰਸ 'ਤੇ ਜਾਂਦਾ ਏ ਆ ਅਤੇ ਉੱਥੋਂ ਦੇ ਬਜ਼ਾਰਾਂ ਉਹ ਖਾਣੇ ਦੇ ਲਈ ਕਿਸ ਤਰ੍ਹਾਂ ਓਹਨਾਂ ਨੂੰ ਜੀ ਆਇਆਂ ਕਹਿੰਦੇ ਆ ਅਤੇ ਮੈਂ ਓਹਦੇ 'ਤੇ ਫਿਲਮ ਤਾਂ ਵੇਖਣਾ ਚਾਹੁੰਦੀ ਹਾਂ ਹਾਂਜੀ ਕਿਉਂਕਿ ਤਾਂ ਕਿ ਮੈਂ ਓਹਨੂੰ ਬਿਲਕੁਲ ਸ਼ਾਕਸ਼ਾਤ ਰੂਪ ਦੇ ਵਿੱਚ ਉਹ ਦੇਖ ਸਕਾਂ ਕਿਉਂਕਿ ਹੁਣ ਤਾਂ ਬੁੱਕ ਪੜ੍ਹ ਕੇ ਤਾਂ ਅਸੀਂ ਸਿਰਫ ਆਪਣੇ ਅੰਦਰ ਕਲਪਨਾ ਕਰ ਲੈਂਦੇ ਹਾਂ ਪਰ ਜੇ ਤੁਸੀਂ ਫਿਲਮ ਦੇ ਵਿੱਚ ਦੇ ਰੂਪ ਦੇ ਵਿੱਚ ਦੇਖਦੇ ਹੋ ਤਾਂ ਓਹਨਾਂ ਲੋਕਾਂ ਨੇ ਕਿਸ ਤਰ੍ਹਾਂ ਉਹ ਮੁਹੱਬਤ ਕਰਦੇ ਨੇ ਸਾਨੂੰ ਜਾਂ ਕਿਸ ਤਰ੍ਹਾਂ ਸਾਡਾ ਸਾਂਝਾ ਪੰਜਾਬ ਹੁੰਦਾ ਸੀ ਓਹਦੇ ਬਾਰੇ ਫਿਰ ਅਸੀਂ ਬਹੁਤ ਚੰਗੀ ਤਰ੍ਹਾਂ ਜਾਣ ਸਕਦੇ ਹਾਂ ਮਹਿਸੂਸ ਕਰ ਸਕਦੇ ਹਾਂ